ਕਲਾ ਪ੍ਰਦਰਸ਼ਨੀ ਇਸ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਹੁਨਰ ਜੋ ਪੰਜਾਬੀਆਂ ਦੇ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਮੈਂ ਪਿਛਲੇ ਦਿਨੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋ ਰਹੇ ਮੁਕਾਬਲਿਆਂ ਵਿੱਚ ਭੰਗੜੇ ਦਾ ਪ੍ਰਦਰਸ਼ਨ ਦੇਖਿਆ ਜੋ ਕਿ ਬਹੁਤ ਹੀ ਖੁਸ਼ੀ ਦੇ ਮਾਹੌਲ ਭਰਿਆ ਸੀ ਉਹਨਾਂ ਨੂੰ ਦੇਖ ਕੇ ਪੰਜਾਬ ਦੇ ਮੁੱਛ ਫੁੱਟ ਗੱਭਰੂ ਜੋ ਕਿ ਹੱਟੇ ਕੱਟੇ ਦਲੇਰ ਨਜ਼ਰ ਆਉਂਦੇ ਸੀ ਮੈਂ ਉਹਨਾਂ ਦੇ ਵਿੱਚ ਇੰਨਾਂ ਕੁ ਜ਼ਿਆਦਾ ਖੁੱਬ ਗਿਆ ਕਿ ਮੇਰਾ ਖੁਦ ਦਾ ਮਨ ਉਸ ਵਿੱਚ ਭਾਗ ਲੈਣ ਨੂੰ ਕੀਤਾ ਉਸ ਵਿੱਚ ਪੰਜਾਬ ਦੀ ਆਨ ਸ਼ਾਨ ਨੂੰ ਪੇਸ਼ ਕੀਤਾ ਜਾਂਦਾ ਹੈ ਉਹ ਖੁਸ਼ੀ ਦੇ ਮੌਕੇ 'ਤੇ ਨੱਚ ਟੱਪ ਕੇ ਮਨਾਇਆ ਜਾਂਦਾ ਉਹਦੇ ਨਾਲ ਨਾਲ ਸਾਡੀ ਸਿਹਤ ਨੂੰ ਵੀ ਉਸਦੇ ਬਹੁਤ ਫਾਇਦੇ ਨੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਥਕਾਵਟ ਘੱਟ ਹੁੰਦੀ ਹੈ ਅਤੇ ਸਾਡਾ ਜ਼ੋਰ ਦੇਖਿਆ ਜਾਂਦਾ ਹੈ